ਪੰਜਾਬ ਵਿੱਚ ਰਾਜ ਸਰਕਾਰ ਜਿਹੜੀ ਰਾਜ ਸਰਕਾਰ ਕੰਪਿਊਨਟੀ ਅੰਦਰ ਵੱਖ ਵੱਖ ਝਗੜੇ ਜਿਵੇਂ ਘਰੇਲੂ ਝਗੜੇ ਹੋ ਗਏ ਜਾਂ ਕੋਈ ਵੀ ਆਪਣੇ ਬਾਹਰੀ ਝਗੜੇ ਹੋ ਗਏ ਉਹਨਾਂ ਦੇ ਨਿਪਟਾਰੇ ਲਈ ਸਰਕਾਰ ਵੱਲੋਂ ਸਬ ਕੋਰਟ ਸੁਪਰੀਮ ਕੋਰਟ ਡਿਸਟਰਿਕਟ ਕੋਰਟ ਵਗੈਰਾ ਬਣਾਏ ਗਏ ਨੇ ਇਹਨਾਂ ਇੱਥੇ ਜਿਹੜੇ ਲੋਕਾਂ ਦੇ ਝਗੜਿਆਂ ਦਾ ਹੱਲ ਕੀਤਾ ਜਾਂਦਾ ਇਸ ਦੇ ਇਲਾਵਾ ਸਰਕਾਰ ਦੇ ਜਿਹੜੇ ਰਾਜਨੀਤਿਕ ਆਪਣੇ ਮੁੱਦਿਆਂ ਬਾਰੇ ਮੁੱਦੇ ਹੁੰਦੇ ਨੇ ਜਾਂ ਉਹਨਾਂ ਦਾ ਉਹਨਾਂ ਦਾ ਹੱਲ ਕਰਨ ਜਨਤਕ ਜਾਂ ਰਾਜਨੀਤਿਕ ਮੁੱਦੇ ਉਹਨਾਂ ਦਾ ਹੱਲ ਕਰਨ ਲਈ ਚੋਣਾਂ ਦੀ ਚੋਣਾਂ ਚੋਣਾਂ ਕਰਵਾਈਆਂ ਜਾਂਦੀਆਂ ਚੋਣਾਂ ਕਰਵਾਉਣ ਨਾਲ ਆਪਣੇ ਇੱਕ ਅ ਆਪਣਾ ਐੱਮ ਐੱਲ ਏ ਜਾਂ ਐੱਮ ਪੀ ਵਗੈਰਾ ਚੁਣਿਆ ਜਾਂਦਾ ਜੋ ਆਪਣੇ ਰਾਜਨੀਤਿਕ ਮੁੱਦਿਆਂ ਨੂੰ ਹੱਲ ਕਰਦਾ ਇਸ ਦੇ ਇਲਾਵਾ ਜਿਹੜੇ ਆਪਣੇ ਘਰੇਲੂ ਮੁੱਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਤਾਂ ਆਪਣੇ ਸ ਜਿਵੇਂ ਅਦਾਲਤਾਂ ਦੀ ਹੁੰਦੀ ਹੈ ਇੱਕ ਇੱਕ ਕੋਈ ਵੀ ਇੱਕ ਝਗੜਾ ਉਸ ਨੂੰ ਪੜਚੋਲ ਕਰਨ ਲਈ ਸਭ ਤੋਂ ਪਹਿਲਾਂ ਦੋਵਾਂ ਵਿਰੋਧੀ ਧਿਰਾਂ ਵਿਚਕਾਰ ਗੱਲਬਾਤ ਕੀਤੀ ਜਾਂਦੀ ਹੈ ਫੇਰ ਉਹਨਾਂ ਦੇ ਦੋਵਾਂ ਦੇ ਵਿਚਾਰ ਸੁਣੇ ਜਾਂਦੇ ਨੇ ਵਿਚਾਰ ਸੁਣਨ ਤੋਂ ਬਾਅਦ ਦੋਵਾਂ ਦਾ ਇੱਕ ਸਿੱਟਾ ਕੱਢਿਆ ਜਾਂਦਾ ਸਿੱਟਾ ਕੱਢਣ ਤੋਂ ਬਾਅਦ ਇੱਕ ਇੱਕ ਥਰਡ ਪਾਰਟੀ ਹੁੰਦਾ ਹੈ ਉਸਦੇ ਵੀ ਵਿਚਾਰ ਲਏ ਜਾਂਦੇ ਹੈ ਥਰਡ ਪਾਰਟੀ ਮਤਲਬ ਕੋਈ ਵਿਚੋਲੇ ਦੇ ਤੌਰ 'ਤੇ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਉਸ ਦੇ ਵੀ ਵਿਚਾਰ ਸੁਣੇ ਜਾਂਦੇ ਹਨ ਸਾਰੇ ਵਿਕਲਪ ਸਾਰੇ ਜਿਹੜੇ ਵਿਕਲਪ ਹੁੰਦੇ ਹੈ ਵਿਕਲਪ ਮਤਲਬ ਹੋ ਗਿਆ ਆਪਣੇ ਜਿਹੜੇ ਸਿੱਟੇ ਨੇ ਉਹਨਾਂ ਬਾਰੇ ਉਹਨਾਂ ਬਾਰੇ ਪੜਚੋਲ ਕੀਤੀ ਜਾਂਦੀ ਹੈ ਫੇਰ ਤਣਾਅ ਪੂਰਨ ਕਰਕੇ ਇਸ ਵਿੱਚ ਇਹਨਾਂ ਦੇ ਹੱਲ ਲੱਭਿਆ ਜਾਂਦਾ ਇਹ ਹੱਲ ਲੱਭਣ ਲਈ ਕਈ ਤਾਂ ਆਪਾਂ ਘਰੇਲੂ ਤੌਰ 'ਤੇ ਵੀ ਕਰ ਲੈਂਦੇ ਜਿਵੇਂ ਕਿ ਪੰਚਾਇਤਾਂ ਦੇ ਥਰੂਅ ਉਹਨਾਂ ਦੇ ਥਰੂਅ ਹੋ ਜਾਂਦੇ ਨੇ ਕਈ ਆਪਾਂ ਕੋਰਟ ਦੇ ਥਰੂਅ ਕਰਦੇ ਹਾਂ ਜਿਵੇਂ ਕਿ ਡਿਸਟਰਿਕਟ ਕੋਰਟ ਹੈ ਸਭ ਤੋਂ ਪਹਿਲਾਂ ਜਿਵੇਂ ਡਿਸਟ੍ਰਿਕਟ ਕੋਰਟ ਆਇਆ ਡਿਸਟ੍ਰਿਕਟ ਕੋਰਟ ਤੋਂ ਬਾਅਦ ਆਪਣਾ ਆਪਣਾ ਸਟੇਟ ਲੈਵਲ ਦਾ ਕੋਰਟ ਆ ਗਿਆ ਉਹ ਤੋਂ ਬਾਅਦ ਸੁਪਰੀਮ ਕੋਰਟ ਆ ਗਿਆ ਉੱਥੇ ਇਹਨਾਂ ਮਸਲਿਆਂ ਦਾ ਹੱਲ ਕੀਤਾ ਜਾਂਦਾ ਹੈ